ਹਾਂਜੀ ਭਾਈ ਸਾਹਿਬ ਤੁਸੀਂ ਅੰਮ੍ਰਿਤ ਬੇਕਰੀ ਤੋਂ ਬੋਲ ਰਹੇ ਹੋ ਮੈਂ ਅੰਮ੍ਰਿਤ ਬੇਕਰੀ ਨੂੰ ਫੋਨ ਲਾਇਆ ਸੀ ਜੀ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਸਰ ਕਿ ਮੇਰੇ ਬੇਟੇ ਦਾ ਜਨਮਦਿਨ ਹੈ ਅਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੋਲ ਰਿਹਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮੈਂ ਅੰਦਰ ਹੀ ਯੂਨੀਵਰਸਿਟੀ ਦੇ ਵਿੱਚ ਮੇਰਾ ਟੀਚਰ ਫਲੈਟ ਤੇਤੀ ਨੰਬਰ ਹੈ ਅਤੇ ਮੇਰੇ ਬੇਟੇ ਦਾ ਜਨਮਦਿਨ ਹੈ ਜੀ ਸਤਾਈ ਜਨਵਰੀ ਦਾ ਅਤੇ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਕਿ ਅਸੀਂ ਇੱਕ ਇਕੱਤਰਤਾ ਕੀਤੀ ਸੀ ਇਸ ਸੰਬੰਧ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੀ ਅਤੇ ਤੁਸੀਂ ਸਤਾਈ ਜਨਵਰੀ ਨੂੰ ਸ਼ਾਮ ਨੂੰ ਚਾਰ ਕੁ ਵਜੇ ਦੇ ਕਰੀਬ ਇੱਕ ਕੇਕ ਵਨੀਲਾ ਫਲੇਬਰ ਵਾਲਾ ਦੇਖ ਲਿਓ ਜੀ ਇੱਕ ਕੇਕ ਅਤੇ ਪੰਜਾਹ ਪੈਟੀਜ ਅਤੇ ਇਸ ਤੋਂ ਇਲਾਵਾ ਤੁਸੀਂ ਦੋ ਵੱਡੀਆਂ ਬੋਤਲਾਂ ਆਪਣਾ ਲਿਮਕਾ ਅਤੇ ਫੈਂਟਾ ਕੋਲਡ ਡਰਿੰਕ ਦੀਆਂ ਵੀ ਉਹਦੇ ਵਿੱਚ ਐਡ ਕਰ ਦਿਉ ਅਤੇ ਇਸ ਤੋਂ ਇਲਾਵਾ ਤੁਸੀਂ ਉਹਦੇ ਵਿੱਚ ਕੁਛ ਸੈਂਡਵਿਚ ਵੀ ਐਡ ਕਰ ਦਿਉ ਉਹਨਾਂ ਦੀ ਗਿਣਤੀ ਵੀ ਚਲੋ ਤੁਸੀਂ ਪੰਜਾਹ ਹੀ ਰੱਖ ਲਿਓ ਜੀ ਅਤੇ ਕਿਰਪਾ ਕਰਕੇ ਇਹ ਜਿਹੜਾ ਔਡਰ ਹੈ ਜੀ ਇਹਨੂੰ ਤੁਸੀਂ ਟਾਈਮ ਸਿਰ ਪਹੁੰਚਦਾ ਕਰ ਦਿਉ ਕਿਉਂਕਿ ਲਗਭਗ ਕਾਫੀ ਮੇਰੇ ਬੇਟੇ ਦੇ ਫਰੈਂਡਸ ਨੇ ਵੀ ਦੋਸਤਾਂ ਮਿੱਤਰਾਂ ਨੇ ਵੀ ਅਤੇ ਮੇਰੇ ਆਪਣੇ ਸਰਕਲ ਦੇ ਵਿੱਚੋਂ ਵੀ ਕਾਫੀ ਬੰਦਿਆਂ ਨੇ ਆਉਣਾ ਜੀ ਤੁਹਾਨੂੰ ਇਹੀ ਬੇਨਤੀ ਕਰਨੀ ਸੀ ਜੀ ਸੋ ਟਾਈਮ ਸਿਰ ਪਹੁੰਚਦਾ ਕਰ ਦਿਉ ਜੀ ਕੁਆ ਆਪਣੇ ਕੁਆਲਿਟੀ ਦਾ ਧਿਆਨ ਰੱਖਿਉ ਜੀ ਧੰਨਵਾਦ ਜੀ